ਹੈਲੋ ਤੁਸੀਂ ਫਲਿਪਕਾਰਟ ਤੋਂ ਗੱਲ ਕਰ ਰਹੇ ਹੋ ਐਕਚੁਅਲੀ ਥੋੜ੍ਹੇ ਟਾਈਮ ਪਹਿਲਾਂ ਫਲਿਪਕਾਰਟ 'ਤੇ ਇੱਕ ਓਫਰ ਲੱਗੀ ਹੋਈ ਸੀਗੀ ਹੈਂਡਬੈਗਸ ਦੇ ਉੱਪਰ ਸੋ ਉਹ ਓਫਰ ਮੈਨੂੰ ਕਾਫੀ ਹੀ ਜ਼ਿਆਦਾ ਅੱਛੀ ਲੱਗੀ ਹੈਗੀ ਇਸ ਕਰਕੇ ਮੈਂ ਉਹ ਓਰਡਰ ਕੀਤਾ ਹੈਗਾ ਹੈਂਡਬੈਗ ਸੋ ਮੈਂ ਉੱਥੇ ਹੀ ਲਿਖਿਆ ਹੋਇਆ ਸੀਗਾ ਕਿ ਜਿਹੜੀ ਡਿਲੀਵਰੀ ਆ ਉਹ ਤੁਹਾਨੂੰ ਪੰਜ ਤੋਂ ਛੇ ਦਿਨਾਂ ਦੇ ਵਿੱਚ ਵਿੱਚ ਮਿਲੇਗੀ ਬਟ ਮੈਨੂੰ ਡਿਲੀਵਰੀ ਦੋ ਦਿਨ ਦੇ ਵਿੱਚ ਵਿੱਚ ਹੀ ਮਿਲ ਗਈ ਸੋ ਮੈਨੂੰ ਬਹੁਤ ਹੀ ਅੱਛਾ ਲੱਗਾ ਕਿ ਫਲਿਪਕਾਰਟ ਦੀ ਸਰਵਿਸ ਇਨੀ ਜ਼ਿਆਦਾ ਫਾਸਟ ਵਾ ਸਲਿੰਗ ਬੈਗ ਵੀ ਬਹੁਤ ਹੀ ਅੱਛਾ ਹੈ ਬਹੁਤ ਜ਼ਿਆਦਾ ਅਫੋਰਡੇਬਲ ਸੀਗਾ ਬਹੁਤ ਹੀ ਡਿਜ਼ਾਇਨਰ ਵੀ ਐਲੀਗੈਂਟ ਸੀਗਾ ਲੁੱਕ ਉਹਦੀ ਓਵਰਔਲ ਲੁੱਕ ਬਹੁਤ ਹੀ ਜ਼ਿਆਦਾ ਅੱਛੀ ਸੀਗੀ ਬਹੁਤ ਹੀ ਲਾਈਟਵੇਟ ਹੀ ਵੈਰੀ ਇਜ਼ੀ ਟੂ ਕੈਰੀ ਜ਼ਿਆਦਾ ਕੋਈ ਉਹਦੀ ਗ੍ਰਿੱਪ ਵੀ ਬਹੁਤ ਅੱਛੀ ਬਹੁਤ ਜ਼ਿਆਦਾ ਸਟਰੋਂਗ ਸੀਗੀ ਉਹਨੂੰ ਉਹਨੂੰ ਮੈਂ ਸ਼ੋਲਡਰ 'ਤੇ ਵੀ ਕੈਰੀ ਕਰ ਸਕਦੀ ਹਾਂ ਮੈਂ ਹੈਂਡ 'ਚ ਵੀ ਕੈਰੀ ਕਰ ਸਕਦੀ ਹਾਂ ਸੋ ਇਹ ਚੀਜ਼ ਮੈਨੂੰ ਬਹੁਤ ਅੱਛੀ ਲੱਗੀ ਜੋ ਡਲਿਵਰੀ ਪਰਸਨ ਸੀ ਉਹ ਵੀ ਬਹੁਤ ਹੀ ਜ਼ਿਆਦਾ ਪੋਲਾਈਟ ਸੀਗਾ ਬਹੁਤ ਅੱਛੇ ਵੇ ਨਾਲ ਉਹਨੇ ਮੈਨੂੰ ਮਤਲਬ ਬਿਲਕੁਲ ਟਾਈਮ 'ਤੇ ਡਿਲਿਵਰੀ ਦੇ ਦਿੱਤੀ ਐਡਰੈੱਸ ਲੱਭਣ ਵਿਚ ਵੀ ਉਹਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੋਈ ਬਿਲਕੁਲ ਸਹੀ ਤਰੀਕੇ ਨਾਲ ਪਹੁੰਚ ਗਿਆ ਬਿਨ੍ਹਾਂ ਮੈਨੂੰ ਡਿਸਟਰਬ ਕੀਤੀ ਹੋਏ ਸੋ ਓਵਰਔਲ ਰਿਵਿਊ ਬਹੁਤ ਹੀ ਅੱਛਾ ਹੈ ਪ੍ਰੋਡਕਟ ਦਾ ਉਹਦੀਆਂ ਜੋ ਚੇਨ ਸੀਗੀਆਂ ਉਹ ਵੀ ਬਹੁਤ ਅੱਛੀਆਂ ਹੈਗੀਆਂ ਯੂ ਨੋ ਬਹੁਤ ਹੀ ਇਜ਼ੀਲੀ ਸਮੂਦਲੀ ਫਲਿਪ ਹੋ ਜਾਂਦੀਆਂ ਹੈ ਸੋ ਓਵਰਔਲ ਮੈਨੂੰ ਪ੍ਰੋਡਕਟ ਬਹੁਤ ਜ਼ਿਆਦਾ ਅੱਛਾ ਲੱਗਾ ਥੈਂਕ ਯੂ ਸੋ ਮਚ